ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਦੁਰਗਿਆਨਾ ਮੰਦਿਰ ਜਲ੍ਹਿਆਂਵਾਲਾ ਬਾਗ ਬਾਘਾ ਬਾਰਡਰ ਮਥੁਰਾ 'ਚ ਸ਼੍ਰੀ ਕ੍ਰਿਸ਼ਨ ਜੀ ਦੇ ਮੰਦਿਰ ਨੇ ਅਤੇ ਮਥੁਰਾ ਦਾ ਪੇੜਾ ਵੀ ਬਹੁਤ ਮਸ਼ਹੂਰ ਹੈ ਆਗਰੇ 'ਚ ਤਾਜ ਮਹਿਲ ਹੈ ਆਗਰੇ ਦਾ ਪੇਠਾ ਵੀ ਬਹੁਤ ਮਸ਼ਹੂਰ ਹੈ ਆਯੋਧਿਆ 'ਚ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ਨੇ ਬੋਮਬੇ ਚ ਸਮੁੰਦਰ ਹੈ ਇੰਡੀਆ ਗੇਟ ਹੈ ਸੈਲਾਨੀ ਆਕਰਸ਼ਣ ਹੈਗੇ ਨੇ ਡਲਹੋਜ਼ੀ ਸ਼ਿਮਲਾ ਮਨਾਲੀ ਜੰਮੂ ਕਸ਼ਮੀਰ ਲੇਹ ਲੱਦਾਖ ਸੈਲਾਨੀ ਵੱਖ ਵੱਖ ਥਾਵਾਂ ਤੋਂ ਆਉਂਦੇ ਨੇ ਅਤੇ ਹਰੀਆਂ ਮੌਸਮ ਦਾ ਆਨੰਦ ਮਾਣਦੇ ਨੇ ਬਰਫ ਪਈ ਹੁੰਦੀ ਹੈ ਪਹਾੜਾਂ 'ਤੇ ਅਤੇ ਬਹੁਤ ਹੀ ਲੋਕ ਆਨੰਦ ਮਾਣਦੇ ਨੇ ਉਹਨਾਂ ਦਾ